ਸਤਿ ਸ਼੍ਰੀ ਅਕਾਲ ਜੀ ਟੈਕਨੋਲਜੀ ਦੇ ਆਉਣ ਕਰਕੇ ਸਾਡੀ ਯਾਤਰਾ ਬਹੁਤ ਹੀ ਆਸਾਨ ਹੋ ਗਈ ਹੈ ਅਸੀਂ ਘਰ ਬੈਠ ਕੇ ਹੀ ਜਹਾਜ ਬਸ ਅਤੇ ਟਰੇਨ ਦੀ ਟਿਕਟ ਬੁੱਕ ਕਰਵਾ ਸਕਦੇ ਹਾਂ ਅਸੀਂ ਕਿਤੇ ਜਾ ਕੇ ਹੋਟਲ ਬੁੱਕ ਕਰਵਾਉਣਾ ਹੈ ਤਾਂ ਅਸੀਂ ਉਹ ਵੀ ਪਹਿਲਾਂ ਹੀ ਦੇਖ ਕੇ ਬੁੱਕ ਕਰਵਾ ਸਕਦੇ ਹਾਂ ਅਸੀਂ ਆਪਣੇ ਪਸੰਦ ਦਾ ਰੂਮ ਵੀ ਲੈ ਸਕਦੇ ਹਾਂ ਇਸ ਤੋਂ ਇਲਾਵਾ ਯਾਤਰਾ ਦੇ ਵਿੱਚ ਕੋਈ ਵੀ ਅਪਡੇਟ ਆਉਂਦੀ ਹੈ ਤਾਂ ਉਸ ਦਾ ਪਤਾ ਵੀ ਸਾਨੂੰ ਫੋਨ ਉੱਪਰ ਹੀ ਲੱਗ ਜਾਂਦਾ ਹੈ ਕੋਈ ਗੱਡੀ ਲੇਟ ਹੈ ਕਿਸੇ ਗੱਡੀ ਦਾ ਪਲੇਟਫਾਰਮ ਨੰਬਰ ਕਿਹੜਾ ਹੈ ਸਟੇਸ਼ਨ ਕਿਹੜਾ ਹੈ ਉਸ ਦੀ ਜਾਣਕਾਰੀ ਵੀ ਸਾਨੂੰ ਆਸਾਨੀ ਨਾਲ ਫੋਨ ਉੱਤੇ ਹੀ ਮਿਲ ਜਾਂਦੀ ਹੈ ਅਸੀਂ ਔਨਲਾਈਨ ਹੀ ਪੇਮੈਂਟ ਵੀ ਕਰ ਸਕ ਕਰ ਦਿੰਦੇ ਹਾਂ ਜਿਸ ਦੇ ਨਾਲ ਸਾਨੂੰ ਕੋਈ ਦਿੱਕਤ ਨਹੀਂ ਆਉਂਦੀ ਇਸ ਦੇ ਨਾਲ ਸਾਡਾ ਸਮਾਂ ਬਚਦਾ ਹੈ ਅਤੇ ਸਾਨੂੰ ਜ਼ਿਆਦਾ ਖੱਜਲ ਖੁਆਰ ਨਹੀਂ ਹੋਣਾ ਪੈਂਦਾ ਅਸਲ ਦੇ ਵਿੱਚ ਟੈਕਨੋਲਜੀ ਨੇ ਸਾਡੀ ਯਾਤਰਾ ਨੂੰ ਆਸਾਨ ਬਣਾਉਣ ਦੇ ਵਿੱਚ ਕਾਫੀ ਮਦਦ ਕੀਤੀ ਹੈ ਧੰਨਵਾਦ ਜੀ